ਸਤਿ ਸ੍ਰੀ ਅਕਾਲ ਸਰ ਸਰ ਮੈਂ ਦਵਿੰਦਰ ਸਿੰਘ ਗੱਲ ਕਰ ਰਿਹਾ ਮੈਂ ਇਸ ਟਾਈਮ ਹਵਾਈ ਅੱਡੇ 'ਤੇ ਸ਼੍ਰੀ ਅੰਮ੍ਰਿਤਸਰ ਵਿਖੇ ਮੌਜੂਦ ਆ ਸਰ ਸਰ ਮੈਂ ਨਾ ਆਪਣਾ ਉਪਭੋਗਤਾ ਬਿੱਲ ਉਹ ਸਰ ਮੈਂ ਇੱਕ ਪਰੂਫ ਵਜੋਂ ਮੈਂ ਦਿਖਾਉਣਾ ਸੀਗਾ ਪਰ ਮੈਂ ਐਮਰਜੈਂਸੀ ਦੇ ਵਿੱਚ ਕਿਉਂਕਿ ਫਲਾਈਟ ਦਾ ਟਾਈਮ ਸੀਗਾ ਤਾਂ ਮੈਂ ਉਹ ਭੁੱਲ ਚੁੱਕਾ ਘਰ ਭੁੱਲ ਘਰ ਘਰ ਭੁੱਲ ਗਿਆ ਸੀ ਬਿੱਲ ਤਾਂ ਕਰਕੇ ਸਰ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਇੱਕ ਸਬੂਤ ਹੈ ਮੈਂ ਉੱਥੇ ਸ਼ੋ ਕਰਨਾ ਹੈ ਅਤੇ ਤੁਸੀਂ ਮੈਨੂੰ ਆਨਲਾਈਨ ਸਬੂਤ ਵਾਪਿਸ ਤੋਂ ਫਿਰ ਦੇ ਦੋ ਜਿਹੜਾ ਮੇਰਾ ਅਕਾਊਂਟ ਨੰਬਰ ਹੈ ਮੈਂ ਤੁਹਾਨੂੰ ਆਪਣਾ ਅਕਾਊਂਟ ਨੰਬਰ ਲਿਖਵਾ ਦਿੰਦਾ ਸਰ ਤੁਸੀਂ ਉਸ ਮੇਰੀ ਆਈਡੀ ਦੇ ਵਿੱਚ ਜਾ ਕੇ ਸਰ ਤੁਸੀਂ ਮੈਨੂੰ ਪਲੀਜ਼ ਤੁਸੀਂ ਇਸ ਚੀਜ਼ ਨੂੰ ਪਰੂਫ ਕੱਢ ਕੇ ਮੈਨੂੰ ਦੇ ਦੋ ਸਰ ਹਵਾਈ ਅੱਡੇ 'ਤੇ ਪਰੂਫ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਇਸ ਟਾਈਮ ਮੈਂ ਆਪਣੇ ਘਰ ਤੋਂ ਸੌ ਕਿਲੋਮੀਟਰ ਦੂਰ ਹਾਂ ਸਰ ਤਾਂ ਕਰਕੇ ਮੈਨੂੰ ਉੱਥੋਂ ਮੰਗਵਾਉਣਾ ਬਹੁਤ ਹੀ ਜ਼ਿਆਦਾ ਔਖਾ ਹੈ ਅਤੇ ਮੈਂ ਤੁਹਾਨੂੰ ਆਪਣਾ ਅਕਾਊਂਟ ਨੰਬਰ ਦੱਸ ਦਿੰਦਾ ਸਰ ਮੋਬਾਇਲ ਨੰਬਰ ਦੱਸ ਦਿੰਦਾ ਸਰ ਆਪਣੀ ਡਿਟੇਲ ਦੱਸ ਦੇਣਾ ਸਰ ਠੀਕ ਹੈ ਉਸ ਤੋਂ ਮੈਨੂੰ ਤੁਸੀਂ ਕੱਢ ਕੇ ਅਤੇ ਮੈਨੂੰ ਸੋਫਟ ਕਾਪੀ ਪਲੀਜ਼ ਸਰ ਪ੍ਰੋਵਾਈਡ ਕਰ ਦੋ ਮੈਂ ਆਪ ਜੀ ਦਾ ਬਹੁਤ ਹੀ ਧੰਨਵਾਦ ਧੰਨਵਾਦੀ ਹੋਵਾਂਗਾ ਸਰ ਓਕੇ